ਸਤਿ ਸ਼੍ਰੀ ਅਕਾਲ ਸਰ ਮੈਂ ਪਠਾਨਕੋਟ ਤੋਂ ਬੋਲ ਰਿਹਾ ਕਾਰਤਿਕ ਸਰ ਮੈਨੂੰ ਰਨਿੰਗ ਕਰਨ ਦਾ ਕਾਫੀ ਜ਼ਿਆਦਾ ਸੌਂਕ ਹੈਗਾ ਇਹ ਸ਼ੌਂਕ ਸਰ ਮੈਨੂੰ ਬਚਪਨ ਤੋਂ ਹੀ ਹੈਗਾ ਮੈਨੂੰ ਕਿਉਂਕਿ ਮੈਂ ਆਰਮੀ ਵਿੱਚ ਜਾਣਾ ਚਾਹੁੰਦਾ ਮੈਨੂੰ ਭਰਤੀਆਂ ਦਾ ਬਹੁਤ ਸ਼ੌਂਕ ਹੈਗਾ ਉਸ ਲਈ ਮੇਰੇ ਦ ਦੌੜ ਹੋਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀ ਆ ਔਰ ਰਨਿੰਗ ਕਰਨ ਦੇ ਕਾਫੀ ਜ਼ਿਆਦਾ ਫਾਇਦੇ ਨੇ ਜਿਸ ਨਾਲ ਕਿ ਸਿਹਤ ਤੰਦਰੁਸਤ ਰਹਿੰਦੀ ਹੈ ਮੋਟਾਪਾ ਨਹੀਂ ਆਉਂਦਾ ਔਰ ਵੀ ਅਸੀਂ ਕਈ ਬਿਮਾਰੀਆਂ ਤੋਂ ਦੂਰ ਰਹਿੰਦੇ ਹਾਂ ਔਰ ਰਨਿੰਗ ਕਰਨ ਦਾ ਕਰਨ ਦੀ ਨਾਲ ਨਾਲ ਅਸੀਂ ਸਵੇਰੇ ਜਲਦੀ ਉੱਠ ਜਾਂਦੇ ਹਾਂ ਰਨਿੰਗ ਦੇ ਬਹਾਨੇ ਜੋ ਕਿ ਸਾਡੇ ਸਰੀਰ ਲਈ ਸਾਰਿਆਂ ਨਾਲੋਂ ਜ਼ਿਆਦਾ ਵਧੀਆ ਹੈਗੀ ਹੈ ਕਿਉਂਕਿ ਸਾਡੇ ਪੁਰਾਤਨ ਗ੍ਰੰਥਾਂ 'ਚ ਵੀ ਲਿਖਿਆ ਗਿਆ ਹੈ ਕਿ ਸਾਨੂੰ ਸੂਰਿਆ ਉਦੇ ਹੋਣ ਤੋਂ ਪਹਿਲਾਂ ਹੀ ਉੱਠ ਜਾਣਾ ਚਾਹੀਦਾ ਹੈ ਔਰ ਰਨਿੰਗ ਕਰਨ ਦੇ ਬਹਾਨੇ ਅਸੀਂ ਸਵੇਰੇ ਜਲਦੀ ਉੱਠ ਵੀ ਜਾਂਦੇ ਹਾਂ ਔਰ ਰਨਿੰਗ ਵੀ ਕਰ ਲੈਂਦੇ ਹਾਂ ਔਰ ਸਾਡਾ ਸਾਰਾ ਦਿਨ ਵੀ ਬੁਹਤ ਅੱਛਾ ਜਾਂਦਾ ਹੈ ਰਨਿੰਗ ਕਰਨ ਨਾਲ ਸਾਡੀ ਕਾਫੀ ਸਿਹਤ ਵੀ ਤੰਦਰੁਸਤ ਰਹਿੰਦੀ ਹੈ ਔਰ ਰਨਿੰਗ ਕਰਨ ਨਾਲ ਇੱਕ ਨਾ ਇੱਕ ਦਿਨ ਅਸੀਂ ਕਾਮਯਾਬ ਹੋ ਜਾਵਾਂਗੇ ਔਰ ਨੌਕਰੀ ਵੀ ਭਰਤੀ ਵੀ ਲੱਗ ਜਾ ਲੱਗ ਸਕਦੇ ਹਾਂ ਮਾਲਕ ਦੀ ਕਿਰਪਾ ਰਹੀ ਤਾਂ ਰਨਿੰਗ ਕਰਨ ਨਾਲ ਸਾਡੀ ਕਈ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਰਨਿੰਗ ਕਰਨ ਨਾਲ ਸਾਡੇ ਲੱ ਸਾਡੀ ਲੱਤਾਂ ਦੇ ਲੱਤਾਂ 'ਚ ਕਾਫੀ ਜ਼ਿਆਦਾ ਜੋਰ ਆਉਂਦਾ ਹੈਗਾ ਔਰ ਰਨਿੰਗ ਕਰਨ ਤੋਂ ਬਾਅਦ ਸਾਨੂੰ ਅ ਵਾਰਮਅਪ ਰਨਿੰਗ ਕਰਨ ਤੋਂ ਪਹਿਲਾਂ ਸਾਨੂੰ ਵਾਰਮਅਪ ਕਰ ਲੈਣਾ ਚਾਹੀਦਾ ਹੈ ਕਿਉਂਕਿ ਉਸ ਨਾਲ ਸਾਡੇ ਦੌੜ ਲਗਾਉਣ ਵੇਲੇ ਦਰਦਾਂ ਨਹੀਂ ਹੁੰਦੀਆਂ ਕਿਉਂਕਿ ਰਨਿੰਗ ਕਈ ਕਈ ਸਿੱਧਾ ਹੀ ਡਾਇਰੈਕਟ ਹੀ ਦੌੜ ਲਗਾ ਲੈਂਦੇ ਹਨ ਜਿਸ ਨਾਲ ਉਹਨਾਂ ਦੇ ਸਰੀਰ ਵਿੱਚ ਕਾਫੀ ਜ਼ਿਆਦਾ ਦਰਦਾਂ ਹੁੰਦੀਆਂ ਹਨ ਅਤੇ ਉਹ ਫਿਰ ਬਾਅਦ ਵਿੱਚ ਪਛਤਾਉਂਦੇ ਨੇ ਕਿ ਸਾਡੇ ਦੌੜ ਨਹੀਂ ਲੱਗੀ ਔਰ ਫਿਰ ਉਹਨਾਂ ਨੂੰ ਮੈਡੀਸੀਨ ਲੈਣੀ ਪੈਂਦੀ ਹੈ ਇਸ ਲਈ ਹਮੇਸ਼ਾ ਰਨਿੰਗ ਕਰਨ ਤੋਂ ਪਹਿਲਾਂ ਵਾਰਮਅਪ ਕਰ ਲੈਣਾ ਚਾਹੀਦਾ ਹੈ ਔਰ ਰਨਿੰਗ ਕਰਨ ਦੇ ਕਾਫੀ ਫਾਇਦੇ ਨੇ ਔਰ ਮੈਨੂੰ ਵੀ ਕਾਫੀ ਫਾਇਦਾ ਹੋਇਆ ਹੈ ਕਿਉਂਕਿ ਪਹਿਲੇ ਮੈਂ ਕਾਫੀ ਮੋਟਾ ਸੀ ਹੁਣ ਮੇਰਾ ਸਰੀਰ ਬਿਲਕੁਲ ਫਿਟ ਹੈਗਾ ਔਰ ਮੈਂ ਆਪਣੇ ਆਪ ਨੂੰ ਬਹੁਤ ਹੀ ਤੰਦਰੁਸਤ ਮਹਿਸੂਸ ਕਰਦਾ ਹਾਂ ਇਸ ਲਈ ਮੈਂ ਸਾਰਿਆਂ ਨੂੰ ਸਲਾਹ ਦੇਣਾ ਚਾਹਾਂਗਾ ਕਿ ਸਾਰੇ ਜਣੇ ਰਨਿੰਗ ਕਰਨ ਔਰ ਸਵੇਰੇ ਜਲਦੀ ਉੱਠਣ ਧੰਨਵਾਦ